ਰੋਜ਼ਾਨਾ ਦੌੜਨ ਨਾਲ ਜਾਂ ਜੌਗਿੰਗ ਕਰਨ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਨ ਇਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਸਰੀਰ ਤਰੋਤਾਜ਼ਾ ਫੀਲ ਆਪਾਂ ਮਹਿਸੂਸ ਕਰਦੇ ਹਨ ਰੋਜ਼ਾਨਾ ਕਿ ਜ਼ਿੰਦਗੀ ਵਿੱਚ ਰੋਜ਼ਾਨਾ ਆਪਾਂ ਜਦੋਂ ਦਸ ਹਜ਼ਾਰ ਕਦਮ ਵੀ ਚਲਦੇ ਹਾਂ ਤਾਂ ਇਸ ਨਾਲ ਸਰੀਰ ਕਈ ਬਿਮਾਰੀਆਂ ਤੋਂ ਦੂਰ ਹੋ ਜਾਂਦਾ ਹੈ ਸਰੀਰ ਸਾਡਾ ਅ ਰੋਗ ਮੁਕਤ ਹੁੰਦਾ ਹੈ ਕਿਸੇ ਵੀ ਉਮਰ ਵਿੱਚ ਜਦੋਂ ਹਰ ਇੱਕ ਉਮਰ ਦਾ ਬੰਦਾ ਟਹਿਲ ਸਕਦਾ ਹੈ ਕਿਉਂਕਿ ਦੌੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਜਦੋਂ ਆਪਾਂ ਕਦੀ ਦੌੜਨਾ ਸ਼ੁਰੂ ਕਰਦੇ ਹਨ ਪੈਰਾਂ ਵਿੱਚ ਮੋਚ ਆ ਜਾਂਦੀ ਹੈ ਮਾਸਪੇਸ਼ੀਆਂ ਫੁੱਲ ਜਾਂਦੀਆਂ ਹਨ ਸਾਹ ਸਾਹ ਚੜਨ ਲੱਗ ਪੈਂਦਾ ਹੈ ਇਹੋ ਜਿਹੀ ਸਮੱਸਿਆ ਆਉਂਦੀਆਂ ਹਨ ਇਸ ਲਈ ਉਹਨਾਂ ਨੂੰ ਦੌੜਨਾ ਨਹੀਂ ਚਾਹੀਦਾ ਅਤੇ ਆਪਾਂ ਸਿਰਫ ਆਪਾਂ ਕਿ ਚੱਲ ਸਕਦੇ ਹਨ ਜੌਗਿੰਗ ਕਰ ਸਕਦੇ ਹਨ ਇਹ ਰੋਜ਼ਾਨਾ ਇਸ ਨਾਲ ਕਰਨ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਸਾਡੇ ਸਰੀਰ ਦਾ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਫਲੋਅ ਵੱਧਦਾ ਹੈ ਸਾਨੂੰ ਆਪਣੇ ਇਸ ਤਰ੍ਹਾਂ ਦੀ ਹਲਕੀਆਂ ਐਕਸਰਸਾਈਜ਼ ਕਰਨ ਨਾਲ ਜਿਵੇਂ ਕਿ ਰਨਿੰਗ ਕਰਨ ਨਾਲ ਸਾਡਾ ਸਰੀਰ ਦਾ ਭਾਰ ਵੀ ਘੱਟਦਾ ਹੈ ਇਹ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹਨ ਇਸ ਨਾਲ ਸਾਡੇ ਸਰੀਰ ਦੀ ਚਮੜੀ ਅ ਜੋ ਚਰਬੀ ਹੁੰਦੀ ਹੈ ਉਹ ਘੱਟ ਹੁੰਦੀ ਹੈ ਸਾਡੀ ਕੈਲਰੀ ਬਰਨ ਹੁੰਦੀ ਹੈ ਇਸ ਨਾਲ ਕਰਨ ਨਾਲ ਸਰੀਰ ਰੋਗ ਤੋਂ ਰੋਗ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਸਰੀਰ ਦੇ ਸਾਡੇ ਦਰਦ ਖਤਮ ਹੋ ਜਾਂਦੇ ਹਨ ਇਸ ਨਾਲ ਜਿਸ ਜਿਵੇਂ ਲੋਕਾਂ ਸਰੀਰ ਸਿਹਤਮੰਦ ਫੀਲ ਕਰਦੇ ਹਾਂ ਰੋਜ਼ਾਨਾ ਤੁਰਨ ਨਾਲ ਜਾਂ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਹਨ ਰੋਜ਼ਾਨਾ ਟਹਿਲਣ ਨਾਲ ਸਾਡੇ ਸਰੀਰ ਨੂੰ ਅਸੀਂ ਬਹੁਤ ਤੰਦਰੁਸਤ ਫੀ ਮਹਿਸੂਸ ਕਰਦੇ ਹਾਂ ਇਸ ਨਾਲ ਸਾਡੀਆਂ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਹਨ ਦੌੜਨ ਵਜ਼ਨ ਵੀ ਸਾਡਾ ਘੱਟ ਹੁੰਦਾ ਹੈ ਚਰਬੀ ਸਾਡੀ ਚਰਬੀ ਘੱਟ ਹੁੰਦੀ ਹੈ ਦੌੜਨ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਧੰਨਵਾਦ